ਹੈਲੋ ਵਧੀਆ ਨਵਜੋਤ ਕਿੱਦਾਂ ਵਧੀਆ ਮੈਂ ਵੀ ਠੀਕ ਹਾਂ ਹੋਰ ਮੈਂ ਕੁਛ ਨਹੀਂ ਮੈਂ ਕੰਮ 'ਤੇ ਸੀ ਹਾਂ ਵਧੀਆ ਠੀਕ ਆ ਘਰ ਹਾਂਜੀ ਵਧੀਆ ਹਾਂਜੀ ਬੋਲੋ

ਹਾਂ ਹਾਂ ਪੀ ਜੀ ਹੈਗੇ ਆ ਵਾਧੂ ਆ ਕਾਲਜ ਦੇ ਨੇੜੇ ਹੈ ਬਹੁਤ ਵਧੀਆ ਪੀ ਜੀ ਹੈਗੇ ਆ ਇੱਕ ਮੇਰੇ ਨੋਨ ਦੇ ਵਿੱਚ ਵੀ ਹੈਗਾ ਜਿੱਦਾਂ ਕਿ ਕ੍ਰਿਸ਼ਨਾ ਪੀ ਜੀ ਆ ਉਹਨਾਂ ਦਾ ਔਰ ਉੱਥੇ ਲੜਕੀਆਂ ਰਹਿੰਦੀਆਂ ਕਾਫੀ ਪਹਿਲਾਂ ਤੋਂ ਵੀ ਰਹਿ ਰਹੀਆਂ ਥੋੜ੍ਹੀ ਦੂਰ ਦੀਆਂ ਜਿੱਦਾਂ ਲੜਕੀਆਂ ਨੇ ਉਹ ਪੀ ਜੀ ਉਹਨਾਂ ਨੇ ਲਿਆ ਹੋਇਆ ਆ ਅਤੇ ਉਹ ਦੱਸ ਰਹੀਆਂ ਸੀ ਬਹੁਤ ਵਧੀਆ ਪੀ ਜੀ ਆ ਤੁਸੀਂ ਇੱਕ ਵਾਰ ਦੇਖ ਲੈਣਾ ਉਥੋਂ ਵੀ ਅਤੇ ਵਧੀਆ ਬੈਡਰੂਮ ਵੀ ਹੈਗੇ ਨੇ ਵਧੀਆ ਸਰਵਿਸ ਨੇ ਉਹਨਾਂ ਦੀ ਹਾਂ ਬਿਲਕੁਲ ਸਿੰਗਲ ਰੂਮ ਵੀ ਉਹ ਪ੍ਰੋਵਾਈਡ ਕਰਵਾ ਦਿੰਦੇ ਨੇ ਉੱਦਾਂ ਤੁਸੀਂ ਇਕੱਲੇ ਨੇ ਰਹਿਣਾ ਹੋਇਆ ਜਿੱਦਾਂ ਰਾਤ ਨੂੰ ਸਟਡੀ ਵਗੈਰਾ ਕਰਨੀ ਡਿਸਟਰਬ ਨਹੀਂ ਹੋਵੋਗੇ ਤੁਸੀਂ ਕੱਲਿਆਂ ਲਈ ਵੀ ਮਿਲ ਜਾਏਗਾ ਹਾਂ ਅਤੇ ਉਹ ਤੋਂ ਹਾਂ ਮੈਂ ਉਹਨਾਂ ਦਾ ਨੰਬਰ ਤੁਹਾਨੂੰ ਸੈਂਡ ਕਰ ਦਵਾਂਗਾ ਲੈ ਕੇ ਔਰ ਮੈਂ ਇੱਕ ਵਾਰ ਆਪ ਵੀ ਜਾ ਕੇ ਉੱਥੇ ਦੇਖ ਆਉਣਾ ਹੈ ਨਾ ਵੀ ਉਹ ਕਿੱਦਾਂ ਕੀ ਕੁਛ ਹੈਗਾ ਆ ਅਤੇ ਰੂਮ ਵਗੈਰਾ ਕਿੱਦਾਂ ਦੇ ਹੈਗੇ ਆ ਗਰਮੀਆਂ ਦੇ ਲਈ ਹਾਂ ਉਹ ਟਿਫਨ ਟਿਫਨ ਵੀ ਕਰਵਾ ਦਿੰਦੇ ਆ ਉਹਨਾ ਹਾਂ ਬਿਲਕੁਲ ਉਹ ਪੀ ਜੀ ਵਾਲੇ ਟਿਫਨ ਵੀ ਕਰਵਾ ਦੇਣਗੇ ਤੁਹਾਨੂੰ ਖਾਣ ਪੀਣ ਦੇ ਲਈ ਆ ਬੈਟਰ ਰਹੇਗਾ ਜੇ ਤੁਸੀਂ ਬਾਹਰੋਂ ਨਹੀਂ ਕੁਛ ਮੰਗਵਾਉਣਾ ਤਾਂ ਉੱਥੇ ਆਪਣਾ ਟਿਫਨ ਵੀ ਲਗਵਾ ਸਕਦੇ ਹੋ ਹਾਂ ਵਧੀਆ ਪੀ ਜੀ ਰੇਟ ਦੇ ਵਿੱਚ ਹੈ ਨਾ ਔਰ ਉਹ ਕਾਲਜ ਦੇ ਨੇੜੇ ਹੀ ਆ ਕਿਉਂਕਿ ਜ਼ਿਆਦਾ ਦੂਰ ਵੀ ਨਹੀਂ ਜਾਣਾ ਪੈਣਾ ਤੁਸੀਂ ਭਾਵੇਂ ਪੈਦਲ ਹੀ ਕਾ ਕਾਲਜ ਜਾ ਸਕਦੇ ਹੋ ਅਤੇ ਪੈਦਲ ਹੀ ਕਾਲਜ ਤੋਂ ਵਾਪਸ ਵੀ ਆ ਸਕਦੇ ਹੈ ਨਾ ਉੱਥੇ ਇੰਨੀ ਦੂਰ ਨਹੀਂ ਗਾ ਕਾਲਜ ਦੇ ਜਮਾਂ ਲਾਗੇ ਹੀ ਆ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਹਾਂਜੀ ਬਿਲਕੁਲ

ਕੋਈ ਗੱਲ ਨਹੀਂ

ਬਿਲਕੁਲ ਜੀ ਉਹ ਤੁਹਾਡਾ ਟਾਈਮ ਬਚ ਜਾਏਗਾ ਹੈ ਨਾ ਜਿੱਦਾਂ ਵੀ ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਮਾਰਨਿੰਗ ਸਵੇਰੇ ਉੱਠ ਕੇ ਆਉਣਾ ਅਤੇ ਸ਼ਾਮ ਨੂੰ ਜਾਣਾ ਸ਼ਾਮ ਨੂੰ ਹਾਂ ਹਨੇਰਾ ਹੋ ਜਾਂਦਾ ਆ ਇਸ ਲਈ ਉੱਥੇ ਜਿੰਨਾ ਕੁ ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਉੰਨਾਂ ਕੁ ਟਾਈਮ ਪੰਜ ਮਿੰਟ ਲੱਗਣੇ ਪੀ ਜੀ 'ਚ ਆ ਕੇ ਉੰਨਾ ਤੁਸੀਂ ਪੜ੍ਹ ਸਕਦੇ ਹੋ ਆਪਣਾ ਜਾਂ ਕੋਈ ਹੋਰ ਕੰਮ ਕਰਨਾ ਉਹ ਕਰ ਸਕਦੇ ਹੋ ਪੀ ਜੀ ਬਹੁਤ ਵਧੀਆ ਆ ਨੇੜੇ ਹੀ ਆ ਨਾਲੇ ਹਾਂ ਅਤੇ ਨੇੜੇ ਹੀ ਆ ਹਾਂ ਮੈਂ ਮੈਂ ਤੁਹਾਨੂੰ ਉੱਥੇ ਜਾ ਕੇ ਪਿਕਚਰ ਕਲਿਕ ਕਰਕੇ ਵੀ ਤੁਹਾਨੂੰ ਸੈਂਡ ਕਰ ਦਵਾਂਗਾ ਕੋਈ ਹਾਂ ਇੱਦਾਂ ਦਾ ਵੀ ਮੈਂ ਦੇਖ ਲਵਾਂਗਾ ਚੈੱਕ ਕਰ ਲਵਾਂਗਾ ਜਾ ਕੇ ਰੂਮ ਵਗੈਰਾ ਕਿੱਦਾਂ ਆ ਅਤੇ ਤਾਂ ਉਹ ਰੈਂਟ ਵਗੈਰਾ ਕੀ ਲੈਂਦੇ ਆ ਹੈ ਨਾ ਹਾਂ ਮੈਂ ਤੁਹਾਨੂੰ ਨੰਬਰ ਹਾਂ ਅਤੇ ਟਿਫਨ ਦੇ ਵਿੱਚ ਕੀ ਕਹਿੰਦੇ ਉਹਨੂੰ ਤੁਸੀਂ ਨੋਨਵੈੱਜ ਵਗੈਰਾ ਖਾ ਲੈਂਦੇ ਹਾਂ ਜਾਂ ਇਕੱਲਾ ਵੈਜ ਓਕੇ ਚਲੋ ਠੀਕ ਹਾਂ ਹਾਂ ਨਹੀਂ ਉਹ ਫਿਰ ਇੱਦਾਂ ਦਾ ਉਹਨਾਂ ਨੂੰ ਪੁੱਛ ਲੈਣਾ ਵੀ ਹਾਂ ਸਿੰਪਲ ਬਣਾਉਂਦੇ ਆ ਕੋਈ ਉੱਦਾਂ ਦਾ ਤਾਂ ਨਹੀਂ ਹੈਗਾ ਨਹੀਂ ਕੋਈ ਗੱਲ ਨਹੀਂ ਠੀਕ ਆ ਤੁਹਾਨੂੰ ਮੈਂ ਜਾ ਕੇ ਅੱਜ ਪਤਾ ਕਰਕੇ ਸਾਰਾ ਕੁਛ ਦੱਸ ਦਿੰਦਾ ਹਾਂ ਕੀ ਉਹਨਾਂ ਦਾ ਰੈਂਟ ਲੈਂਦੇ ਆ ਹੈ ਨਾ ਹਾਂ ਨੰਬਰ ਸੈਂਡ ਕਰਦੂੰ ਬਿਲਕੁਲ ਠੀਕ ਆ ਜੀ ਜੀ ਜੀ ਠੀਕ ਆ ਹਾਂ ਵੈਸੇ ਤਾਂ ਲੜਕੀਆਂ ਦੱਸ ਰਹੀਆਂ ਸੀ ਬਹੁਤ ਵਧੀਆ ਪੀ ਜੀ ਆ ਤਾਂ ਮੈਂ ਇੱਕ ਵਾਰ ਜਾ ਜ਼ਰੂਰ ਜਾ ਕੇ ਪਤਾ ਕਰਕੇ ਫਿਰ ਤੁਹਾਨੂੰ ਦੱਸ ਦਊਂਗਾ ਜੀ ਓਕੇ ਥੈਂਕ ਯੂ